ਵੈਸੇ ਤਾਂ ਮੈਂ ਨੋਰਮਲ ਇਲਾਕਿਆਂ 'ਚ ਬਾਈਕਿੰਗ ਕੀਤੀ ਹੈ ਬਾਈਕਿੰਗ ਵਾਸਤੇ ਮੇਰਾ ਮੇਨ ਮਨ ਕਰ ਰਿਹਾ ਵੀ ਮੈਂ ਪਹਾੜੀ ਏਰੀਏ ਵਿੱਚ ਬਾਈਕਿੰਗ ਕਰਾਂ ਅਤੇ ਫੁੱਲ ਸਪੀਡਾਂ ਉੱਤੇ ਜਿਵੇਂ ਨੋਰਮਲੀ ਏਰੀਏ 'ਚ ਜਾਂਦੇ ਹਾਂ ਤਾਂ ਪਹਾੜੀ ਵਾਲੇ ਏਰੀਏ 'ਚ ਆਪਣਾ ਫੁੱਲ ਸਪੀਡ ਨਾਲ ਬਾਈਕਿੰਗ ਲੈ ਕੇ ਇੱਕ ਵਲਡ ਰਿਕਾਰਡ ਬਣਾਈਏ ਕਿਉਂਕਿ ਉੱਥੇ ਇੱਕ ਪਾਸੇ ਖਾਈ ਹੁੰਦੀ ਇੱਕ ਪਾਸੇ ਪਹਾੜ ਅਤੇ ਉਹ ਬਹੁਤ ਹੀ ਮੁਸ਼ਕਲ ਸਫਰ ਹੁੰਦਾ ਹੈ ਜਿਸ ਨੂੰ ਆਪਾਂ ਵੱਧ ਤੋਂ ਵੱਧ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਆਪਣੀ ਬਾਈਕ 'ਤੇ ਕੰਟਰੋਲ ਰੱਖ ਕੇ ਆਪਣੀ ਮੰਜ਼ਿਲ 'ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਮੈਂ ਇੱਕ ਵਾਰ ਉੱਥੇ ਜ਼ਰੂਰ ਜਾ ਕੇ ਪਹਾੜੀ ਏਰੀਏ 'ਚ ਬਾਈਕ ਦਾ ਸ ਸਫਰ ਜ਼ਰੂਰ ਕਰੂੰਗਾ